ਮੇਰੀ ਮਨਪਸੰਦ ਕਿਤਾਬ ਪੰਜਾਬੀ ਦੀ ਹੈ ਇਸ ਵਿੱਚ ਬਹੁਤ ਹੀ ਵਧੀਆ ਵਧੀਆ ਐੱਸਏ ਅਤੇ ਸਟੋਰੀਆਂ ਹਨ ਜੋ ਕਿ ਮੈਨੂੰ ਬਹੁਤ ਹੀ ਮਨੋਰੰਜਨ ਕਰਦੀਆਂ ਹਨ ਮੈਂ ਪੰਜਾਬੀ ਦੀ ਪੁਸਤਕ ਇੱਕ ਦਿਨ ਵਿੱਚ ਘੰਟਾ ਜਾਂ ਦੋ ਘੰਟਾ ਪੜ੍ਹਦਾ ਹੀ ਹਾਂ ਇਹ ਮੇਰੀ ਮਾਤ ਭਾਸ਼ਾ ਹੈ ਮੇਰੀ ਪੰਜਾਬੀ ਦੇ ਪੰਜ ਸੌ ਪੰਨੇ ਹਨ ਇਸਦੀ ਜਿਲਦ ਲਾਲ ਰੰਗ ਦੀ ਹੈ ਅਤੇ ਮੈਂ ਪੰਜਾਬੀ ਪੜ੍ਹਨ ਦਾ ਸ਼ੌਕੀਨ ਹਾਂ ਮੈਨੂੰ ਪੰਜਾਬੀ ਪੜ੍ਹ ਕੇ ਬਹੁਤ ਹੀ ਆਨੰਦ ਆਉਂਦਾ ਹੈ ਇਸ ਵਿੱਚ ਲੇਖ ਅਤੇ ਸ ਕਹਾਣੀਆਂ ਬਹੁਤ ਹੀ ਮਨੋਰੰਜਨ ਹਨ